ਪੰਜਾਬੀ ਸਲਵਾਰਾਂ ਦੀਆਂ ਅਲੱਗ ਅਲੱਗ ਕਿਸਮਾਂ ਹੁੰਦੀਆਂ ਹੈ ਜਿਵੇਂ ਪਟਿਆਲਾ ਸਲਵਾਰ ਅਫ਼ਗਾਨੀ ਸਲਵਾਰ ਸਿੰਪਲ ਸਲਵਾਰ ਧੋਤੀ ਸਲਵਾਰ ਪਟਿਆਲਾ ਸਲਵਾਰ ਵਿੱਚ ਕਾਫ਼ੀ ਜ਼ਿਆਦਾ ਚੋਨਾ ਪਾਈਆਂ ਹੁੰਦੀਆਂ ਨੇ ਅਤੇ ਜਿਹੜੀਆਂ ਧੋਤੀ ਸਲਵਾਰ ਦੇ ਸਾਈਡਾਂ 'ਤੇ ਚੋਨਾ ਹੁੰਦੀਆਂ ਅਤੇ ਜਿਹੜੀ ਸਿੰਪਲ ਸਲਵਾਰ ਉਹਦੇ ਤਾਂ ਅੱਗੇ ਪਿੱਛੇ ਚੋਨਾ ਹੁੰਦੀਆਂ ਅਤੇ ਜਿਹੜੀ ਆ ਅਫ਼ਗਾਨੀ ਸਲਵਾਰ ਦੇ ਨੀਚੇ ਗੋਲ ਪਹੁੰਚਾ ਹੁੰਦਾ ਅਤੇ ਨਾਲ ਉਹਦੇ ਥੱਲੇ ਚੋਨਾ ਪਾਈਆਂ ਹੁੰਦੀਆਂ ਧੰਨਵਾਦ